ਸਤਿ ਸ਼੍ਰੀ ਅਕਾਲ ਜੀ ਤੁਸੀਂ ਉਬਰ ਕੈਬ ਤੋਂ ਬੋਲਦੇ ਹਾਂ ਜੀ ਅਸੀਂ ਇੱਕ ਟੈਕਸੀ ਬੁੱਕ ਕਰਨੀ ਸੀਗੀ ਜੀ ਅਸੀਂ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਆਉਣਾ ਸੀਗਾ ਜੀ ਉੱਥੇ ਮੇਰੇ ਫਰੈਂਡ ਦੇ ਨਾ ਮਦਰ ਫਾਦਰ ਜੌਬ ਕਰਦੇ ਨੇ ਅਤੇ ਉਹਨਾਂ ਨੇ ਇੱਥੇ ਲੋਕਲ ਆਪਣੇ ਬੇਟੇ ਦੇ ਵਿਆਹ ਵਿੱਚ ਆਉਣਾ ਸੀਗਾ ਅਤੇ ਉਹਨਾਂ ਦੇ ਨਾ ਉੱਧਰ ਟੈਕਸੀ ਦੀ ਬਹੁਤ ਪਰੋਬਲਮ ਚੱਲ ਰਹੀ ਏ ਅਤੇ ਮੈਂ ਸੁਣਿਆ ਉੱਧਰ ਮੀਂਹ ਦੀ ਵੀ ਬਹੁਤ ਸੰਭਾਵਨਾ ਏ ਅਤੇ ਰੋਡ 'ਤੇ ਨਾ ਜਾਮ ਜਿਹਾ ਵੀ ਬਹੁਤ ਏ ਅਤੇ ਆਪਾਂ ਇੱਧਰੋਂ ਟੈਕਸੀ ਬੁੱਕ ਕਰਕੇ ਉੱਧਰ ਜਾਣਾ ਆਪਾਂ ਨੂੰ ਰਸਤੇ ਵਿੱਚ ਟੋਲ ਟੈਕਸ ਵੀ ਬਹੁਤ ਪੈਣੇ ਨੇ ਅਤੇ ਉਹਨਾਂ ਦਾ ਵੀ ਵਿੱਚ ਖਰਚਾ ਮਿਲਾ ਕੇ ਅਤੇ